ਪਸ਼ੂਆਂ ਲਈ ਸਭ ਤੋਂ ਵਧੀਆ ਰੂਟੀਨ ਕਿਹੜੀ ਹੈ ਉਸ ਬਾਰੇ ਦੱਸਣ ਲੱਗਾ ਮੈਂ ਅਸੀਂ ਸਵੇਰੇ ਉੱਠ ਕੇ ਪਸ਼ੂਆਂ ਨਾਲ ਪਿਆਰ ਨਾਲ ਸਹਿਲਾਂਦੇ ਹਾਂ ਅਤੇ ਉਹਨਾਂ ਨੂੰ ਉਹਦੀ ਖੁਰਲੀ ਵਿੱਚ ਤੂੜੀ ਖਲ ਸ਼ਾਨ ਦਾ ਚਾਰਾ ਪਾਉਂਦੇ ਹਾਂ ਬਾਅਦ ਵਿੱਚ ਅਸੀਂ ਧਾਰ ਲਈ ਕੱਢਦੇ ਹਾਂ ਧਾਰ ਕੱਢਣ ਲਈ ਫਿਰ ਥੋੜ੍ਹਾ ਸਾ ਸ਼ਾਨ ਵਗੈਰਾ ਆਟਾ ਪਾ ਦਿੰਦੇ ਹਾਂ ਫਿਰ ਉਹਨਾਂ ਨੂੰ ਅਸੀਂ ਧਾਰ ਕੱਢਣ ਤੋਂ ਬਾਅਦ ਪਸ਼ੂਆਂ ਨੂੰ ਸਹਿਲਾਂਦੇ ਹਾਂ ਥਾਪੀ ਦਿੰਦੇ ਹਾਂ ਫਿਰ ਦਸ ਵਜੇ ਦੇ ਕਰੀਬ ਉਹਨਾਂ ਨੂੰ ਨੁਹਾ ਤੋਹਾ ਦਿੰਦੇ ਹਾਂ ਮਾਲਿਸ਼ ਵਗੈਰਾ ਕਰ ਦਿੰਦੇ ਹਾਂ ਬਾਰ੍ਹਾਂ ਵਜੇ ਦੇ ਕਰੀਬ ਉਹਨਾਂ ਨੂੰ ਦੁਪਹਿਰ ਦਾ ਪੱਠੇ ਘਾਹ ਤੂੜੀ ਮਿਕਸ ਕਰਕੇ ਖੁਰਲੀ ਵਿੱਚ ਪਾਉਂਦੇ ਹਾਂ ਫਿਰ ਸ਼ਾਮ ਨੂੰ ਪਸ਼ੂਆਂ ਨੂੰ ਚਾਰਾ ਦਿੰਦੇ ਹਾਂ ਜਿੱਦਾਂ ਕਿ ਤੂੜੀ ਦਾ ਗਤਾਵਾ ਕਰ ਦਿੱਤਾ ਛੱਲ ਪਾ ਤੇ ਖਾਣ ਪਾ ਤੀ ਫਿਰ ਸ਼ਾਮ ਨੂੰ ਧਾਰ ਵੀ ਕੱਢਦੇ ਹਾਂ ਧਾਰ ਕੱਢਣ ਤੋਂ ਬਾਅਦ ਫਿਰ ਸਹਿਲਾਉਂਦੇ ਹਾਂ ਉਹਨਾਂ ਨੂੰ ਫਿਰ ਰਾਤ ਨੂੰ ਵੀ ਇਸੇ ਤਰ੍ਹਾਂ ਹੀ ਧੁੱਪ ਵੇਲੇ ਅਸੀਂ ਉਹਨਾਂ ਦੇ ਛਾਂ ਕਰਤੀ ਕਿਸੇ ਛਾਂ ਜਗ੍ਹਾ 'ਤੇ ਸਰਦੀਆਂ ਨੂੰ ਅੰਦਰ ਕਮਰੇ 'ਚ